ਮੈਂ ਸਬਜ਼ੀ ਵਾਲੀ ਰੇਹੜੀ ਕੋਲ ਖੜ੍ਹੀ ਹਾਂ ਤੁਸੀਂ ਕਿੱਥੇ ਹੋ ਮੈਨੂੰ ਦਿਸ ਨਹੀਂ ਰਹੇ ਇੱਥੇ ਇੱਕ ਸਬਜ਼ੀ ਵਾਲੀ ਰੇਹੜੀ ਖੜ੍ਹੀ ਹੈ ਤਾਂ ਮੈਂ ਉਸਦੇ ਕੋਲ ਖੜ੍ਹੀ ਹਾਂ ਤਾਂ ਮੈਨੂੰ ਉੱਥੋਂ ਆ ਕੇ ਤੁਸੀਂ ਲਿਜਾ ਸਕਦੇ